ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਕਿਤਾਬਾਂ ਪੜ੍ਹ ਕੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਇਹਨਾਂ ਤੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਇਹ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਮੇਰੀ ਮੈਨੂੰ ਜ਼ਿੰਦਗੀ ਦੇ ਬਹੁਤ ਜ਼ਿਆਦਾ ਤਜਰਬੇ ਮਿਲੇ ਹਨ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਮੈਂ ਪਾਰ ਕੀਤਾ ਹੈ ਜਿ ਇਵੇਂ ਨਾ ਕਿਤਾਬਾਂ ਵਿੱਚੋਂ ਜਿਵੇਂ ਲੂਮਣਾ ਚਿੱਟਾ ਲਹੂ ਪਿੰਜਰਾ ਲਹੂ ਕੁੱਟਾ ਸ਼ਿਵ ਕੁਮਾਰ ਅੰਮ੍ਰਿਤਾ ਪ੍ਰੀਤਮ ਅਤੇ ਲਫਜ਼ਾਂ ਦੀ ਦਰਗਾਹ ਮਾ ਮਾਲਾ ਮਣਕਾ ਪੱਤਝੜ ਦੀ ਪੰਜੇਬ ਆਦਿ ਬਹੁਤ ਸਾਰੀਆਂ ਫਿ ਕਿਤਾਬਾਂ ਹਨ ਜਿਨ੍ਹਾਂ ਤੋਂ ਮੈਨੂੰ ਸਿੱਖਣ ਨੂੰ ਮਿਲਿਆ ਹੈ ਇਹਨਾਂ ਨੂੰ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖਦੇ ਹਾਂ ਅਤੇ ਜ਼ਿੰਦਗੀ ਦੇ ਵਿੱਚ ਅਸੀਂ ਅੱਗੇ ਸਾਨੂੰ ਅੱਗੇ ਵਧਣ ਦੀ ਦੇ ਲਈ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਇਹ ਇਹਨਾਂ ਦੇ ਨਾਲ ਅਸੀਂ ਦੂਜਿਆਂ ਨੂੰ ਵੀ ਬਹੁਤ ਕੁਛ ਸਿਖਾਉਂਦੇ ਹਾਂ ਜੋ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੀਆਂ ਮੁਸ਼ਕਿਲਾਵਾਂ ਮੁਸ਼ਕਿਲਾਵਾਂ 'ਚ ਅੜੇ ਹਨ ਉਹਨਾਂ ਨੂੰ ਪਾਰ ਨਹੀਂ ਕਰ ਪਾ ਰਹੇ ਹੈ ਉਹਨਾਂ ਦੀ ਉਹਨਾਂ ਉਹਨਾਂ ਨੂੰ ਮਦਦ ਕਰਕੇ ਇਹਨਾਂ ਕਿਤਾਬਾਂ ਨੂੰ ਇਹ ਕਿਤਾਬਾਂ ਉਹਨਾਂ ਨੂੰ ਵੀ ਪੜ੍ਹਨ ਲਈ ਕਹਿੰਦੇ ਹਾਂ ਤਾਂ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਮਦਦ ਮਿਲ ਸਕੇ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਅਸਾਨੀ ਮਿਲੇ ਅਤੇ ਉਹਨਾਂ ਨੂੰ ਪਾਰ ਕਰਕੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਣ ਅਤੇ ਆਪਣੇ ਲਾਈਫ ਨੂੰ ਹੋਰ ਜ਼ਿਆਦਾ ਵਧੀਆ ਬਣਾ ਸਕੇ